ਦੋ ਜੂਨ ਉੱਨੀ ਸੌ ਸਤਾਸੀ ਅੱਠ ਜੂਨ ਉੱਨੀ ਸੌ ਨੱਬੇ ਪੰਜ ਫਰਵਰੀ ਦੌ ਹਜ਼ਾਰ ਚਾਰ ਸੱਤ ਮਾਰਚ ਦੋ ਹਜ਼ਾਰ ਇੱਕੀ ਵੀਹ ਜੁਲਾਈ ਉੱਨੀ ਸੌ ਅਠਾਸੀ